ਮੈਨੂੰ ਪੜ੍ਹਨ ਲਿਖਣ ਦਾ ਬਹੁਤ ਹੀ ਸ਼ੌਕ ਹੈ ਮੈਂ ਚਾਹੁੰਦੀ ਹਾਂ ਕਿ ਸਾਰੀ ਦੁਨੀਆ ਪੜ੍ਹੇ ਲਿਖੇ ਅਤੇ ਉੱਚੇ ਲੈਵਲ 'ਤੇ ਪਹੁੰਚੇ ਮੇਰਾ ਭਰਾ ਮੇਰੇ ਸਾਰੇ ਫੈਮਿਲੀ ਦੇ ਵਿੱਚ ਬਹੁਤ ਜ਼ਿਆਦਾ ਪੜ੍ਹੇ ਲਿਖੇ ਹੈ ਮੈਂ ਵੀ ਚਾਹੁੰਦੀ ਕਿ ਮੇਰਾ ਭਰਾ ਬਹੁਤ ਹਾ ਬਹੁਤ ਉੱਚੀ ਸਿੱਖਿਆ ਗ੍ਰਹਿ ਮਤਲਬ ਕਿ ਕਰੇ ਤਾਂ ਕਿ ਉਹ ਵਧੀਆ ਤੋਂ ਵਧੀਆ ਜੋ ਨੌਕਰੀ ਕਰ ਸਕੇ ਅਤੇ ਆਪਣੇ ਦੇਸ਼ ਦਾ ਭਵਿੱਖ ਬਣਾ ਸਕੇ ਜੇਕਰ ਉਹ ਪੜ੍ਹਿਆ ਲਿਖਿਆ ਨਾ ਹੋਵੇਗਾ ਉਹਦਾ ਕੰਮ ਦੂਜੇ ਉਲਟੇ ਪਾਸੇ ਜਾਵੇਗਾ ਕਿ ਨਸ਼ੇ ਕਰਲਾ ਮੈਂ ਉਹ ਕਰਲਾ ਜੇ ਉਹ ਪੜ੍ਹ ਲਿਖ ਜਾਵੇਗਾ ਅਤੇ ਆਪਣੇ ਆਪਣੇ ਬਾਰੇ ਭਲਾ ਸੋਚੇਗਾ ਕਿ ਮੈਂ ਵਧੀਆ ਨੌਕਰੀ 'ਤੇ ਜਾਵਾਂ ਆਪਣੇ ਦੇਸ਼ ਦਾ ਭਵਿੱਖ ਸੁਰੱਖਿਅਤ ਕਰਾਂ ਆਪਣੇ ਦੇਸ਼ ਨੂੰ ਉੱਚਾ ਲੈ ਕੇ ਜਾਵਾਂ ਅਤੇ ਆਪਣੇ ਘਰਦਿਆਂ ਦੀ ਸਾਰੀਆਂ ਜਰੂਰਤਾਂ ਪੂਰੀਆਂ ਕਰ ਸਕਾਂ ਜੇ ਮੇਰਾ ਭਰਾ ਪੜ੍ਹੇ ਲਿਖੇਗਾ ਨਹੀਂ ਤਾਂ ਉਹ ਕਿੱਦਾਂ ਸਾਰੀਆਂ ਜਰੂਰਤਾਂ ਪੂਰੀਆਂ ਕਰ ਸਕੇਗਾ ਇਸ ਕਰਕੇ ਮੈਂ ਚਾਹੁੰਦੀ ਹਾਂ ਕਿ ਮੇਰਾ ਭਰਾ ਬਹੁਤ ਜਿਆਦਾ ਤਰੱਕੀ ਕਰੇ ਬਹੁਤ ਜ਼ਿਆਦਾ ਪੜ੍ਹੇ ਲਿਖੇ ਅਤੇ ਉੱਚੀ ਨੌਕਰੀ ਪ੍ਰਾਪਤ ਕਰ ਸਕੇ ਤਾਂ ਕਿ ਉਹ ਸਾਰੇ ਪਰਿਵਾਰ ਦੀ ਆਪਣੇ ਆਪਣਾ ਸਟੈਂਡ ਲੈ ਸਕੇ ਅਤੇ ਆਪਣੇ ਵਧੀਆ ਨੌਕਰੀ ਕਰ ਸਕੇ ਤਾਂ ਜਿਹਦੇ ਨਾਲ ਸਾਰਾ ਉਹਦਾ ਖ਼ਰਚਾ ਚੁੱਕ ਸਕੇ ਉਹ ਆਪਣੀ ਵਧੀਆ ਲਾਈਫ ਜੀਵੇ ਅਤੇ ਆਪਣੀ ਜ਼ਿੰਦਗੀ ਨੂੰ ਪੂਰੀ ਤਰ੍ਹਾਂ ਸੁਰੱਖਿਅਤ ਕਰ ਸਕੇ ਜੇਕਰ ਉਹ ਪੜ੍ਹਿਆ ਲਿਖਿਆ ਹੋਵੇਗਾ ਅਤੇ ਆਪਣੀਆਂ ਜ਼ਰੂਰਤਾਂ ਵੀ ਪੂਰੀਆਂ ਕਰੇਗਾ ਆਪਣਾ ਨਾਂ ਵੀ ਰੋਸ਼ਨ ਕਰੇਗਾ ਅਤੇ ਆਪਣੇ ਦੇਸ਼ ਦਾ ਨਾਂ ਵੀ ਰੋਸ਼ਨ ਕਰੇਗਾ ਜੇਕਰ ਉਹ ਪੜ੍ਹਿਆ ਲਿਖਿਆ ਨਾ ਹੋਵੇਗਾ ਤਾਂ ਉਹਦਾ ਦਿਮਾਗ ਜਿਹੜਾ ਹੈ ਖਾਲੀ ਹੋਵੇਗਾ ਅਤੇ ਤੁਹਾਨੂੰ ਪਤਾ ਹੀ ਹੈ ਕਿ ਖਾਲੀ ਦਿਮਾਗ ਜਿਹੜਾ ਉਹ ਸ਼ੈਤਾਨ ਦਾ ਘਰ ਹੁੰਦਾ ਜੇ ਜੇ ਜੇ ਸ਼ੈਤਾਨ ਦਾ ਘਰ ਹੋਵੇਗਾ ਤਾਂ ਉਹਦਾ ਕੰਮ ਪੁੱਠੀਆਂ ਗੱਲਾਂ ਦੇ ਵਿੱਚ ਜ਼ਿਆਦਾ ਪਵੇਗਾ ਜਿੱਦਾਂ ਉਹ ਨਸ਼ੇ ਕਰ ਲਏ ਜਾਂ ਹੋਰ ਕਿਸੇ ਗਲਤ ਰਸਤੇ 'ਤੇ ਤੁਰ ਪਏ ਇਸ ਕਰਕੇ ਮੈਂ ਚਾਹੁੰਦੀ ਹਾਂ ਕਿ ਮੇਰਾ ਭਰਾ ਜਿਹੜਾ ਹੈ ਉਹ ਨਸ਼ਿਆਂ ਨੂੰ ਦੂਰ ਹੋ ਕੇ ਆਪਣੇ ਜਿਹੜੀ ਹੈ ਨਾ ਉਹ ਵਧੀਆ ਸਿੱਖਿਆ ਗ੍ਰਹਿਣ ਕਰੇ ਪੂਰੀ ਤਰ੍ਹਾਂ ਵਧੀਆ ਪੜ੍ਹ ਲਿਖ ਕੇ ਉੱਚੀ ਜੋਬਸ ਕਰ ਸ ਕਰ ਸਕੇ ਤਾਂ ਕਿ ਉਹ ਸਾਡਾ ਸਾਰਿਆਂ ਦਾ ਜਿਹੜਾ ਮਾਣ ਵਧਾ ਸਕੇ